ਅਤੇ ਜੀ ਮੇਰਾ ਨਾਮ ਰੇਖਾ ਹੈ ਗੁਰਦਾਸਪੁਰ ਤੋਂ ਬਿਲੋਂਗ ਕਰਦੀ ਹਾਂ ਸਭ ਤੋਂ ਪਹਿਲਾਂ ਮੈਨੂੰ ਯੋਗਾ ਦੇ ਅਭਿਆਸ ਵਾਲਾ ਮੇਰੀ ਸਰੀਰਿਕ ਪ੍ਰੋਬਲਮ ਨਾਲ ਖਿੱਚਿਆ ਕਿਉਂਕਿ ਮੈਂ ਮੈਂ ਬੜੀ ਜ਼ਿਆਦਾ ਪ੍ਰੋਬਲਮ ਸੀ ਮੈਂ ਬੈਕ ਪੇਨ ਮੈਨੂੰ ਹੀ ਸਰਵਾਈਕਲ ਮੈਨੂੰ ਸੀ ਮਾਈਗਰੇਨ ਮੈਨੂੰ ਹੀ ਲੱਕ ਦੀ ਪ੍ਰੋਬਲਮ ਮੈਨੂੰ ਹੀ ਮੈਂ ਚੱਲ ਫਿਰ ਨਹੀਂ ਸਕਦੀ ਹੀ ਔਰ ਮੈਨੂੰ ਕਿਸੇ ਨੇ ਗਾਈਡੈਂਸ ਕੀਤੀ ਤੂੰ ਯੋਗਾ 'ਤੇ ਆਇਆ ਕਰ ਮੈਂ ਯੋਗਾ 'ਤੇ ਜਾਣ ਨਾਲ ਐਕਸਸਾਈਜ਼ ਕਰਨ ਨਾਲ ਮੈਨੂੰ ਪਹਿਲਾਂ ਤਾਂ ਮੈਂ ਦੋ ਚਾਰ ਦਿਨਾਂ 'ਚ ਮੈਨੂੰ ਬਹੁਤ ਥਕਾਵਟ ਹੋਈ ਉਸ ਤੋਂ ਬਾਅਦ ਮੈਂ ਇਕਦਮ ਹਫਤੇ ਦੇ ਵਿੱਚ ਵਿੱਚ ਠੀਕ ਹੋ ਗਈ ਮੈਨੂੰ ਅਭਿਆਸ ਹੋ ਗਿਆ ਮੈਂ ਚੱਲਣ ਲੱਗ ਪਈ ਇਸ ਕਰਕੇ ਮੈਂ ਆਰਾਮ ਨਾਲ ਕੰਮ ਆਪਣਾ ਯੋਗਾ ਕਰਦੀ ਰਹੀ ਔਰ ਉਹਨਾਂ ਨੇ ਮੈਨੂੰ ਉਹ ਇਸ ਕਰਕੇ ਮੈਨੂੰ ਖਿੱਚ ਪਈ ਕਿ ਇਹਦੇ ਨਾਲ ਤਾਂ ਮੈਂ ਠੀਕ ਹੋ ਸਕਦੀ ਹਾਂ ਤਾਂ ਕਿ ਮੈਨੂੰ ਕਿੰਨੀਆਂ ਚੀਜ਼ਾਂ 'ਚ ਪ੍ਰੋਬਲਮ ਜਿਹੜੀਆਂ ਮੇਰੀ ਠੀਕ ਹੋਈਆਂ ਅਤੇ ਜਦੋਂ ਆਪਣਾ ਸਰੀਰ ਹੀ ਠੀਕ ਹੋ ਜਾਏ ਤਾਂ ਫਿਰ ਖਿੱਚ ਤਾਂ ਆਪੇ ਹੁੰਦੀ ਏ ਕਿ ਆਪਾਂ ਕਰੀਏ ਕੰਮ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਰਹੇ ਇਸ ਕਰਕੇ ਸਰੀਰ ਮੇਰਾ ਤੰਦਰੁਸਤ ਹੋ ਗਿਆ ਇਸ ਕਰਕੇ ਮੈਨੂੰ ਅਭਿਆਸ ਮੈਂ ਜ਼ਰੂਰ ਕਰਦੀ ਹਾਂ ਹੋਰ ਕੰਮ ਚਾਹੇ ਹੋਏ ਨਾ ਹੋਏ ਸਵੇਰੇ ਉੱਠ ਕੇ ਪਹਿਲਾਂ ਮੈਂ ਅਭਿਆਸ ਕਰਦੀ ਹਾਂ ਯੋਗਾ ਕਰਦੀ ਹਾਂ ਉਸ ਤੋਂ ਬਾਅਦ ਮੈਂ ਕੁਛ ਹੋਰ ਕਰਦੀ ਹਾਂ ਪਰ ਸ਼ਾਮ ਨੂੰ ਵੀ ਮੈਂ ਰੂਟੀਨ ਬਣਾਈ ਕਿ ਸ਼ਾਮ ਨੂੰ ਵੀ ਮੈਂ ਯੋਗਾ ਕਰਨਾ ਇਸ ਕਰਕੇ ਮੈਂ ਯੋਗਾ ਯੋਗਾ ਨਾਲ ਮੈਂ ਬਹੁਤ ਮਤਲਬ ਸਰੀਰਕ ਪ੍ਰੋਬਲਮ ਮੇਰੀ ਹੱਲ ਹੋਈ ਹੈ ਇਸ ਕਰਕੇ ਮੈਨੂੰ ਇਹੀ ਖਿਚ ਹੈ ਕਿ ਮੈਂ ਯੋਗਾ ਖੁਦ ਕਰਾਂ ਔਰ ਬਾਕੀਆਂ ਨੂੰ ਵੀ ਪ੍ਰੇਰਿਤ ਕਰਾਂ ਕਿ ਮੈਂ ਤੁਸੀਂ ਵੀ ਯੋਗਾ ਕਰੋ ਜਿਹੜੀ ਸਰੀਰ ਦੀ ਪ੍ਰੋਬਲਮ ਆ ਸਾਡੀਆਂ ਵੀ ਠੀਕ ਹੋਣ ਇਹੀ ਚੀਜ਼ ਆ ਇਹੀ ਅਭਿਆਸ ਮਨ ਵਿੱਚ ਯੋਗੇ ਦੇ ਅਭਿਆਸ ਨੇ ਮੈਨੂੰ ਆਪਣੇ ਵੱਲ ਖਿੱਚ ਪਾਈ ਕਿ ਮੈਂ ਯੋਗਾ ਕਰਾਂ ਹਾਂਜੀ